ਸਮੁ ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਤੈਰਾਕੀ ਬਹੁਤ ਜ਼ਰੂਰੀ ਹੈ ਜਿਹੜੀ ਕਿ ਬੜੇ ਧਿਆਨ ਨਾਲ ਸਿੱਖਣੀ ਚਾਹੀਦੀ ਹੈ ਔਰ ਇਹਦੇ ਵਿੱਚ ਆਪਣੇ ਸਾਹ ਨੂੰ ਕੰਟਰੋਲ ਰੱਖਣਾ ਪੈਂਦਾ ਹੈ ਔਰ ਆਪਣੇ ਸਰੀਰ ਨੂੰ ਫਿਟ ਰੱਖਣਾ ਪੈਂਦਾ ਹੈ ਜਿਹਦੇ ਕਰਕੇ ਕਈ ਲੋਕ ਤੈਰਾਕੀ ਤੋਂ ਆਪਣੇ ਆਪ ਤੋਂ ਪਰਹੇਜ਼ ਕਰਦੇ ਹਨ ਜਦਕਿ ਇਹ ਸਿਹਤ ਲਈ ਬਹੁਤ ਫਾਇਦੇਮੰਦ ਚੀਜ਼ ਹੈ ਜਿਹਦੇ ਕਰਕੇ ਲੋਕਾਂ ਦੀ ਸਿਹਤ ਵੀ ਠੀਕ ਰਹਿੰਦੀ ਹੈ